ਵੈਸੇ ਤਾਂ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਪੰਜਾਬੀ ਭਾਸ਼ਾ ਵਿੱਚ ਹੀ ਕਿਤਾਬਾਂ ਪੜ੍ਹੀਆਂ ਨੇ ਕਿਉਂਕਿ ਮੇਰੀ ਮੂਲ ਭਾਸ਼ਾ ਜਿਹੜੀ ਹੈ ਉਹ ਪੰਜਾਬੀ ਹੈ ਪੰਜਾਬੀ ਵਿੱਚ ਮੈਂ ਬਹੁਤ ਸਾਰੇ ਨਾਵਲ ਕਹਾਣੀਆਂ ਦੀਆਂ ਕਿਤਾਬਾਂ ਜਾਂ ਹੋਰ ਬਹੁਤ ਸਾਰੀਆਂ ਕਿਤਾਬਾਂ ਪੜ੍ਹ ਚੁੱਕੀ ਹਾਂ ਪਰ ਮੈਂ ਇੱਕ ਵਾਰੀ ਮੈਨੂੰ ਹਿੰਦੀ ਇੱਕ ਇੰਗਲਿਸ਼ ਦੀ ਕਿਤਾਬ ਪੜ੍ਹਨ ਦਾ ਮੌਕਾ ਮਿਲਿਆ ਰਿਚ ਡੈਡ ਪੂਅਰ ਡੈਡ ਮੈਨੂੰ ਪੜ੍ਹ ਕੇ ਇਹ ਕਿਤਾਬ ਬੜੀ ਵਧੀਆ ਲੱਗੀ ਉਹਦੇ 'ਚ ਮਤਲਬ ਦੱਸਿਆ ਗਿਆ ਸੀਗਾ ਕਿ ਬੰਦੇ ਨੂੰ ਆਪਣੀ ਆਮਦਨ ਅਨੁਸਾਰ ਹੀ ਖ਼ਰਚ ਕਰਨੇ ਚਾਹੀਦੇ ਨੇ ਜੇ ਤੁਸੀਂ ਆਪਣੇ ਆਮਦਨ ਤੋਂ ਵੱਧ ਖ਼ਰਚ ਕਰਦੇ ਹੋ ਤਾਂ ਤੁਹਾਡਾ ਕੰਮ ਖਰਾਬ ਹੋ ਜਾਂਦਾ ਹੈ ਇਸ ਕਰਕੇ ਨਾ ਮੈਨੂੰ ਇਹ ਥੋੜ੍ਹਾ ਜਿਹਾ ਅ ਪ੍ਰੈਕਟੀਕਲ ਜਿਹੀ ਗੱਲ ਲੱਗੀ ਇਹਦੇ 'ਚ ਤਾਂ ਇਸ ਕਰਕੇ ਮੈਨੂੰ ਇਹ ਰਿਚ ਡੈਡ ਪੂਅਰ ਡੈਡ ਕਿਤਾਬ ਜਿਹੜੀ ਸੀ ਉਹ ਬਹੁਤ ਵਧੀਆ ਲੱਗੀ ਦੂਸਰੀ ਗੱਲ ਜਿਹੜੀ ਹੈਗੀ ਹੈ ਕਿ ਸਾਨੂੰ ਅਨੁਵਾਦਿਤ ਸੰਸਕਰਨ ਬਾਰੇ ਅਸੀਂ ਮੈਂ ਤਾਂ ਇਹ ਸੋਚਦੀ ਹਾਂ ਇਹ ਜਿਹੜੇ ਅਨੁਵਾਦਿਤ ਸੰਸਕਰਨ ਵਾਲਾ ਸਿਲਸਿਲਾ ਹੈ ਇਹ ਇੱਕ ਵਧੀਆ ਉਪਰਾਲਾ ਹੁੰਦਾ ਹੈ ਕਿਉਂਕਿ ਜਦੋਂ ਅ ਕਿਸੇ ਵੀ ਭਾਸ਼ਾ ਦੇ ਵਿੱਚ ਕੋਈ ਵੀ ਰਾਈਟਰ ਜਦੋਂ ਕਿਤਾਬ ਲਿਖਦਾ ਹੈ ਤਾਂ ਉਹ ਜਦੋਂ ਕਿਤਾਬ ਲਿਖਦਾ ਹੈ ਤਾਂ ਬਾਕੀਆਂ ਭਾਸ਼ਾਵਾਂ ਵਾਲੇ ਕਈ ਵਾਰੀ ਉਸ ਨੂੰ ਨਹੀਂ ਪੜ੍ਹ ਪੜ੍ਹ ਸਕਦੇ ਅਤੇ ਜਿਹੜੇ ਲੋਕ ਇਹ ਉਪਰਾਲਾ ਕਰ ਦਿੰਦੇ ਨੇ ਕਿ ਉਸ ਨੂੰ ਦੂਸਰੀ ਭਾਸ਼ਾ ਦੇ ਵਿੱਚ ਟ੍ਰਾਂਸਲੇਟ ਕਰ ਦਿੰਦੇ ਨੇ ਜਾਂ ਅਨੁਵਾਦਿਤ ਕਰ ਦਿੰਦੇ ਨੇ ਤਾਂ ਦੂਜੀਆਂ ਭਾਸ਼ਾਵਾਂ ਦੇ ਲੋਕ ਵੀ ਉਹ ਵਧੀਆ ਮੈਟਰ ਨੂੰ ਪੜ੍ਹਨ ਦੇ ਕਾਬਿਲ ਹੋ ਜਾਂਦੇ ਨੇ ਜੋ ਕਿ ਬਹੁਤ ਵਧੀਆ ਗੱਲ ਹੈ ਬਹੁਤ ਸਾਰੀਆਂ ਕਿਤਾਬਾਂ ਇਸ ਤਰ੍ਹਾਂ ਦੀਆਂ ਹੋ ਵੀ ਚੁੱਕੀਆਂ ਨੇ ਅਤੇ ਇਸ ਤੋਂ ਇਲਾਵਾ ਅਗਲੀ ਚੀਜ਼ ਜਿਹੜੀ ਪੁੱਛੀ ਗਈ ਹੈ ਕਿ ਮਤਲਬ ਤੁਹਾਨੂੰ ਸਾਨੂੰ ਆਪਣੀ ਮੂਲ ਭਾਸ਼ਾ ਵਿੱਚੋਂ ਕੋਈ ਕਿਸ ਕਿਸੇ ਕਿਤਾਬ ਦਾ ਅਜਿਹੀ ਦਾ ਨਾਮ ਦੇਈਏ ਜਿਹੜੀ ਦੁਨੀਆ ਦੇ ਹਰ ਕਿਸੇ ਕੋਨੇ 'ਚ ਪੜ੍ਹੀ ਜਾਵੇ ਤਾਂ ਉਹ ਨਾਮ ਹੈ ਮਾਤ ਲੋਕ ਜਿਹੜੀ ਕਿ ਇੱਕ ਰਾਈਟਰ ਜਸਵਿੰਦਰ ਸਿੰਘ ਜੀ ਨੇ ਲਿਖੀ ਹੈ ਉਹ ਵੈਸੇ ਪਨ ਹਿੰਦੀ ਵਿੱਚ ਅਨੁਵਾਦਿਤ ਹੋ ਚੁੱਕੀ ਹੈ ਪਰ ਇਹਨੂੰ ਮੈਂ ਇਹ ਚਾਹਾਂਗੀ ਕਿ ਮੈਂ ਰਿਕਮੈਂਡ ਕਰਾਂਗੀ ਕਿ ਇਹ ਮਤਲਬ ਪੂਰੀ ਦੁਨੀਆਂ ਦੇ ਵਿੱਚ ਹਰ ਕਿਸੇ ਹਰ ਕਿਸੇ ਕੋਨੇ ਦੇ ਵਿੱਚ ਪੜ੍ਹੀ ਜਾਵੇ ਕਿਉਂਕੀ ਇਹਦੇ ਵਿੱਚ ਪੂਰੀ ਦੁਨੀਆਂ ਦਾ ਜਿਹੜਾ ਹੈ ਬਾਰੇ ਜ਼ਿਕਰ ਹੈ ਮਤਲਬ ਪੂਰੀ ਦੁਨੀਆਂ ਦੇ ਲੋਕ ਇਸ ਚੀਜ਼ ਨੂੰ ਇੰਜੋਏ ਕਰ ਸਕਦੇ ਆ ਅਤੇ ਮਤਲਬ ਇਹ ਮਾਤ ਲੋਕ ਜਿਹੜੀ ਕਿਤਾਬ ਹੈ ਜਸਵਿੰਦਰ ਸਿੰਘ ਦੀ ਇਹ ਬੜਾ ਬੜੀ ਵਧੀਆ ਕਿਤਾਬ ਹੈ